ਘਰ ਦੇ ਵਿੱਚ ਬਗੀਚੀ ਦੀ ਸਾਂਭ ਸੰਭਾਲ ਕਰਨਾ ਸਸਤਾ ਵੀ ਅਤੇ ਕਈ ਵਾਰ ਮਹਿੰਗਾ ਵੀ ਹੋ ਜਾਂਦਾ ਕਿਉਂਕਿ ਉਹ ਪਲਾਂਟ ਦੇ ਅਕੋਰਡਿੰਗ ਡਿਪੈਂਡ ਕਰਦਾ ਅਤੇ ਉਸ ਤੋਂ ਬਾਅਦ ਆਪਾਂ ਸਵੇਰ ਸ਼ਾਮ ਪਾਣੀ ਵੀ ਪਾਉਂਦੇ ਹਾਂ ਅਤੇ ਜਿਹੜੀ ਖਾਦ ਹੈ ਉਹ ਆਪਾਂ ਜਿਵੇਂ ਮੱਝਾਂ ਦਾ ਗੋਬਰ ਵਗੈਰਾ ਉਹ ਹੋ ਗਿਆ ਉਹ ਆਪਾਂ ਪਾ ਸਕਦੇ ਹਾਂ ਖਾਦ ਵਗੈਰਾ ਵੀ ਕਿਉਂਕਿ ਆਪਾਂ ਨੂੰ ਜੇ ਆਪਾਂ ਬਾਹਰੋਂ ਲੈ ਕੇ ਆਉਂਦੇ ਨਰਸਰੀ ਤੋਂ ਤਾਂ ਉਹ ਆਪਾਂ ਨੂੰ ਬਹੁਤ ਜ਼ਿਆਦਾ ਮਹਿੰਗੀ ਮਿਲਦੀ ਆ ਇਸ ਕਰਕੇ ਆਪਾਂ ਘਰ ਵਾਲ਼ੀ ਖਾਦ ਵੀ ਆਪਾਂ ਵਰਤ ਸਕਦੇ ਜਿਵੇਂ ਵੇਸਟਰੇਜ ਹੁੰਦੇ ਆ ਕੂੜਾ ਵਗੈਰਾ ਫਲ਼ਾਂ ਵਗੈਰਾ ਦਾ ਉਹ ਵੀ ਆਪਾਂ ਪਾ ਸਕਦੇ ਹਾਂ ਉਹਦੇ ਵਿੱਚ